ਹਰ ਖਿਡਾਰੀ ਹਰੇਕ ਤਰ੍ਹਾਂ ਦੀ ਖੇਡ ਵਿੱਚ ਆਪਣਾ ਸੰਪੂਰਨ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਜੋ ਇੱਕ ਚੰਗਾ ਖਿਡਾਰੀ ਹੁੰਦਾ ਹੈ ਉਹ ਚੰਗੀ ਖੇਡ ਨੂੰ ਸੈੱਟ ਕਰਨ ਲਈ ਰਣਨੀਤੀ ਘੜਦਾ ਹੈ ਇਸੇ ਲਈ ਉਹ ਬਾਕੀਆਂ ਵਿੱਚ ਪਛਾਣਿਆ ਜਾਂਦਾ ਹੈ ਅਤੇ ਸਾਰੀ ਟੀਮ ਵਿੱਚੋਂ ਉਸ ਨੂੰ ਅਲੱਗ ਪਹਿਚਾਣ ਮਿਲਦੀ ਹੈ ਕਿਉਂਕਿ ਉਸ ਦੀ ਰਣਨੀਤੀ ਉਸ ਨੂੰ ਚੰਗੀ ਖੇਡ ਨੂੰ ਸੈੱਟ ਕਰਨ ਵਿੱਚ ਮਦਦ ਕਰਦੀ ਹੈ